ਸਭ ਤੋਂ ਆਸਧਰਨ ਪੰਛੀ ਮੈਂ ਦੇਖਿਆ ਤਾਂ ਨਹੀਂ ਹੈ ਫਿਰ ਵੀ ਆਪਾਂ ਸਭ ਤੋਂ ਆਸਾਧਨ ਪੰਛੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿਮਾਲਿਆ ਦੇ ਮ ਮ ਮਨਾਲ ਦੇ ਖੇਤਰ ਵਿੱਚ ਦੇਖਿਆ ਹੈ ਇਹ ਪੰਛੀ ਹੈ ਦੇਖਿਆ ਹੈ ਅਤੇ ਇਹ ਪੰਛੀ ਰੰਗ ਬਿਰੰਗਾ ਅਤੇ ਸ਼ਾਨਦਾਰ ਬਹੁਤ ਵਧੀਆ ਹੈ ਇਹ ਪਹਾੜਾਂ ਦੇ ਵਿੱਚ ਰਹਿੰਦਾ ਹੈ ਅਤੇ ਦੁਰਲਭ ਪੰਛੀ ਹੈ ਇਹ ਪੰਛੀ ਅਤੇ ਓਹ ਇਹਦੀ ਜਾਨੀ ਕਿ ਚਮਕਦਾਰ ਨੀਲੇ ਰੰਗ ਹਰੇ ਰੰਗ ਦਾ ਸਹੀ ਰੰਗ ਦਾ ਵੈਲਮੂਜ਼ ਵੈਲਮੂਜ ਨਾਂ ਦਾ ਪੰਛੀ ਹੈ ਇਹਦਾ ਅਤੇ ਇਹਦੀ ਪ ਖੰਭ ਵੀ ਬਹੁਤ ਖੂਬਸੂਰਤ ਸੀ ਇਹ ਅਸੀਂ ਮੈਂ ਵੈਸੇ ਨੈੱਟ 'ਤੇ ਦੇਖਿਆ ਸੀਗਾ ਉੱਦਾਂ ਇਹਨੂੰ ਮੈਂ ਦੇਖਣ ਵਾਸਤੇ ਪੰਛੀ ਸਾਡੇ ਇਲਾਕੇ ਦੇ ਵਿੱਚ ਹਰੀ ਕੇ ਪੱਤਨ ਝੀਲ ਹੈਗੀ ਆ ਉੱਥੇ ਸਾਰੇ ਵਰਲਡ ਦੇ ਪੰਛੀ ਆਉਂਦੇ ਹਨ ਮੈਂ ਉੱਥੇ ਕਈ ਵਾਰੀ ਦੇਖਣ ਦਾ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ ਕਈ ਵਾਰੀ ਮੈਂ ਉੱਥੇ ਜਾ ਕੇ ਦੇਖਦਾ ਹਾਂ ਜਿਸ ਪੰਛੀ ਦੀ ਸਾਨੂੰ ਕੋ ਮੈਨੂੰ ਨੌਲੇਜ ਨਹੀਂ ਹੈਗੀ ਉੱਥੇ ਮੈਂ ਗਾਈਡ ਵਾਲਿਆਂ ਕੋਲ ਜਿਹੜੇ ਉੱਥੇ ਦਿਖਾਉਣ ਵਾਲੇ ਆ ਉਹਨਾਂ ਕੋਲ ਉਹਨਾਂ ਦੀ ਨੌਲੇਜ ਅਤੇ ਜਾਣਕਾਰੀ ਲੈਂਦਾ ਅਤੇ ਉਹਨਾਂ ਪੰਛੀਆਂ ਬਾਰੇ ਜਾਣਕਾਰੀ ਲੈਂਦਾ ਹੈ ਬਾਕੀ ਆਪਣੇ ਜਿਹੜੇ ਪੰਜਾਬ ਦੇ ਪੰਛੀ ਤਾਂ ਸਾਰੇ ਦੇਖੇ ਆ ਦੁਰਲੱਭ ਪੰਛੀ ਜਿਹੜਾ ਇਹ ਹੀ ਹੈ ਦੁਰਲੱਭ ਪੰਛੀ ਅਤੇ ਜਿਸ ਬਾਰੇ ਸਾਨੂੰ ਬਹੁਤ ਹੀ ਵਧੀਆ ਹੈਗਾ ਪੰਛੀ ਦੇਖਣਾ ਵੀ ਚਾਹੀਦਾ ਹੈ ਪੰਜਾਬ ਦੇ ਵਿੱਚ ਬਾਹਰਲੇ ਪੰਛੀ ਦੁਰਲੱਭ ਪੰਛੀ ਵੀ ਦੇਖਣਾ ਚਾਹੀਦਾ ਅਤੇ ਇਸ ਵਾਸਤੇ ਇਹ ਪੰਛੀ ਏ ਮਨਾਲੀ ਦੇ ਵਿੱਚ ਮੈਂ ਨੈਟ ਤੋਂ ਹੀ ਚੈੱਕ ਕੀਤਾ ਹੈ ਦੇਖਿਆ ਸੀ ਓਕੇ